ਹੋਰ ਭਰਾ ਕੀ ਹਾਲ ਆ ਤੇਰਾ ਕਿਉਂ ਕੀ ਹੋ ਗਿਆ ਹਾਂ ਹਾਂ

ਆਹੋ ਆਹੋ ਸਹੀ ਗੱਲ ਆ ਆਹੋ ਆਹੋ

ਆਹੋ

ਆਹੋ ਭਰਾ ਇਹੀ ਹਾਲ ਆ ਸਾਡਾ ਵੀ ਇੱਧਰ ਆਹੋ ਹਾਂ ਘਰ ਦੇ ਹਾਲ ਤਾਂ ਠੀਕ ਆ ਉਹੀ ਜਿਹੜੀ ਤੂੰ ਗੱਲਾਂ ਕਰਨੀਆਂ ਵਾ ਕਣਕ ਲਾਈ ਸੀ ਪਿਛਲੇ ਸਾਲ ਸਾਰੀ ਵਾਹ ਕੇ ਲੈ ਗਿਆ ਹੁਣ ਜਦੋਂ ਧੁੱਪਾਂ ਚਾਹੀਦੀਆਂ ਹੁੰਦੀਆਂ ਉਦੋਂ ਬਰਸਾਤਾਂ ਆ ਜਾਂਦੀਆਂ ਵਾਂ ਅਤੇ ਜਦੋਂ ਬਰਸਾਤਾਂ ਲੈਣੀਆਂ ਹੁੰਦੀਆਂ ਵਾ ਉਦੋਂ ਧੁੱਪਾਂ ਚੜੀਆਂ ਹੁੰਦੀਆਂ ਵਾਂ ਆਪਾਂ ਕਣਕ ਲਾਈ ਸੀ ਅਤੇ ਹੁਣ ਆਪਾਂ ਫਸਲ ਨੂੰ ਵਾਹਣਾ ਸੀ ਤਾਂ ਉੱਥੇ ਬਰਸਾਤ ਹੀ ਆਈ ਜਾਂਦੀ ਬਰਸਾਤ ਹੀ ਆਈ ਜਾਂਦੀ ਹੈ ਸਾਰੀ ਫ਼ਸਲ ਖ਼ਰਾਬ ਹੋ ਜਾਣੀ ਹੈ ਤਰ੍ਹਾਂ ਤਾਂ ਹਾਂ ਚੱਲ ਭਰਾ ਠੀਕ ਆ ਧੰਨਵਾਦ